ਉੱਚ ਸਿੱਖਿਆਵਾਂ ਦੀ ਸੰ ਉੱਚ ਸਿੱਖਿਆਵਾਂ ਦੀ ਸੰਸਥਾਵਾਂ ਦੀ ਭੂਮਿਕਾ ਬੜੀ ਹੀ ਮਹੱਤਵਪੂਰਨ ਹੈ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਜੇ ਦੇਖਿਆ ਜਾਏ ਤਾਂ ਬੱਚੇ ਅੱਜ ਕੱਲ੍ਹ ਸਿਰਫ ਥੋੜ੍ਹੀ ਸਿੱਖਿਆ ਨਹੀਂ ਲੈਂਦੇ ਜੇ ਦੇਖਿਆ ਜਾਏ ਅੰਡਰ ਗ੍ਰੈਜੂਏਟ ਕੋਰਸਿਸ 'ਤੇ ਨਹੀਂ ਰੁਕਦੇ ਹੈ ਜੇ ਪੋਸਟ ਗ੍ਰੈਜੂਏਸ਼ਨ ਵੱਲ ਜਾਣਾ ਚਾਹੁੰਦੇ ਹੈ ਅਤੇ ਪੋਸਟ ਗ੍ਰੈਜੂਏਸ਼ਨ ਜੇ ਪੰਜਾਬ ਵਿੱਚ ਹੀ ਹੋਏਗੀ ਤਾਂ ਲੋਕ ਤਾਂ ਬੱਚੇ ਬੜਾ ਫਾਇਦਾ ਰਹਿੰਦਾ ਹੈ ਉਸ ਚੀਜ਼ ਦਾ ਅਤੇ ਉਹ ਸਮਾਜਿਕ ਅਤੇ ਆਰਥਿਕ ਵਿਕਾਸ 'ਚ ਵੀ ਬੜਾ ਹੈਲਪ ਕਰਦੀ ਹੈ ਕਿਉਂਕਿ ਜਿੱਥੇ ਬੱਚੇ ਪਹਿਲਾਂ ਬਾਹਰ ਪੜ੍ਹਨ ਜਾਂਦੇ ਸੀ ਪਰ ਬਾਹਰ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਬਾਹਰ ਪੜ੍ਹਨਾ ਬੜਾ ਹੀ ਮੁਸ਼ਕਿਲ ਹੈ ਕਿਉਂਕਿ ਆਵਾਜਾਈ ਬੜੀ ਮਹਿੰਗੀ ਹੈ ਕਿਤੇ ਰਹਿਣਾ ਬੜਾ ਮਹਿੰਗਾ ਹੈ ਤਾਂ ਬੱਚੇ ਇਹ ਕਹਿੰਦੇ ਆ ਕਿ ਗ੍ਰੈਜੂਏਸ਼ਨ ਕਰ ਲਈ ਤਾਂ ਬਹੁਤ ਹੈ ਪਰ ਜੇ ਪੰਜਾਬ ਵਿੱਚ ਹੀ ਸਿੱਖਿਆ ਆਰਥਿਕਤਾ ਵਿੱਚ ਉੱਚ ਸਿੱਖਿਆ ਸੰਸਥਾਵਾਂ ਹਨ ਤਾਂ ਉਹ ਸਾਨੂੰ ਬਹੁਤ ਹੈਲਪ ਕਰਦੀ ਹੈ ਸਾਡੇ ਗਿਆਨ 'ਚ ਵਾਧਾ ਕਰਦੀ ਹੈ ਬੱਚਿਆਂ ਦੇ ਗਿਆਨ 'ਚ ਵਾਧਾ ਕਰਦੀ ਹੈ ਅਤੇ ਉਹਨਾਂ ਦਾ ਆਰਥਿਕ ਵਿਕਾਸ ਵੀ ਕਰਦੀ ਹੈ ਕਿਉਂਕਿ ਅੱਜ ਕੱਲ੍ਹ ਅੰਡਰ ਗ੍ਰੈਜੂਏਸ਼ਨ ਦੀ ਬਹੁਤ ਘੱਟ ਵੈਲਿਊ ਹੈ ਜੇ ਪੋਸਟ ਗ੍ਰੈਜੂਏਟ ਹੈਗੇ ਹੈ ਅਤੇ ਤਾਂ ਹੀ ਸਾਨੂੰ ਨੌਕਰੀ ਵੱਲ ਅੱਗੇ ਜਾਣ ਲਈ ਹੈਲਪ ਮਿਲਦੀ ਹੈ ਪੋਸਟ ਗ੍ਰੈਜੂਏਸ਼ਨ ਤੋਂ ਅੱਗੇ ਵੀ ਹੁਣ ਤਾਂ ਆਪਣੀ ਇੱਥੇ ਪੀ ਐਚ ਡੀ ਵਗੈਰਾ ਅਤੇ ਉਸ ਤੋਂ ਬਾਅਦ ਵਾਲੇ ਕੋਰਸਿਸ ਵੀ ਹੋਣ ਲੱਗ ਗਏ ਤਾਂ ਕਰਕੇ ਸਾਨੂੰ ਨੌਕਰੀ ਲੱਭਣ 'ਚ ਵੀ ਬੜੀ ਮਦਦ ਮਿਲ ਰਹੀ ਹੈ ਅਤੇ ਪੰਜਾਬ 'ਚ ਆਰਥਿਕਤਾ ਜੇ ਵਧਾਉਣੀ ਹੈ ਜੇ ਲੋਕਾਂ ਦਾ ਇਕਨੋਮਿਕ ਸਟਰਕਚਰ ਠੀਕ ਕਰਨਾ ਹੈ ਤਾਂ ਸਰਕਾਰੀ ਇਹ ਸਾਰੀਆਂ ਜਿਹੜੀਆਂ ਉੱਚ ਸਿੱਖਿਆ ਸੰਸਥਾਵਾਂ ਹਨ ਇਹੀ ਸਾਡੀ ਮਦਦ ਕਰ ਰਹੀਆਂ ਹਨ ਥੈਂਕ ਯੂ